ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਉਹ ਤੁਸੀਂ ਆਰੀਅਨ ਬਾਬਾ ਦੇ ਭਰਾ ਬੋਲ ਰਹੇ ਹੋ ਅੰਡੇ ਤੇ ਹਾਂਜੀ ਹਾਂਜੀ ਭਾਅ ਜੀ ਮੈਂ ਨਾ ਇਧਰ ਤੁਸੀਂ ਕਪੂਰਥਲੇ ਰਹਿੰਦੇ ਹੋ ਨਾ

ਅੱਛਾ ਅੱਛਾ ਅੱਛਾ ਮੈਂ ਭਾਅ ਜੀ ਉਹ ਆਂਦੇ ਦਾ ਫਰੈਂਡ ਗੁਰੂ ਕਮਲ ਤੁਸੀਂ ਪਹਿਛਾਣ ਹੋਣਾ ਮੈਨੂੰ ਸਰਦਾਰ ਜਿਹੜਾ ਆਂਦੇ ਨਾਲ ਹੁੰਦਾ ਸੀ ਪਹਿਲਾਂ ਅਸੀਂ ਮਿਲੇ ਵੀ ਇੱਕ ਦੋ ਵਾਰੀ ਮੈਨੂੰ ਹਾਂ ਹਾਂ ਤੇ ਭਾਅ ਜੀ ਮੈਂ ਨਾ ਕਪੂਰਥਲਾ ਹਾਲੇ ਨਵਾਂ ਨਵਾਂ ਹੀ ਆਇਆ ਸੀਗਾ ਸ਼ਿਫਟ ਹੋਇਆ ਇਥੇ ਤੇ ਸਟਡੀ ਰਿਲੇਟਿਡ ਇਧਰ ਲੱਗਿਆ ਮੈਂ ਕਾਲਜ 'ਚ ਕਪੂਰਥਲੇ ਕਾਲਜ ਬੀ ਬੀ ਏ ਕਰਨਾ ਤੇ ਇੱਥੇ ਹੋਸਟਲ ਲਿੱਤਾ ਮੈਂ ਤੇ ਮੈਂ ਭਾਅ ਜੀ ਥੋਤੋਂ ਪੁੱਛਣਾ ਸੀਗਾ ਕਿ ਮੈਂ ਨਾ ਵਾਲ ਵੂਲ ਆਪਣੇ ਠੀਕ ਕਰਵਾਉਣਾ ਸੀ ਕਟਿੰਗ ਕੁਟਿੰਗ ਕਰਵਾਉਣੀ ਸੀਗੀ ਤੇ ਇਹਨਾਂ ਲਈ ਕੋਈ ਵਧੀਆ ਸਲੂਨ ਜਾਂ ਕੋਈ ਹੋਰ ਕੋਈ ਸ਼ੋਪ ਹੋਵੇ ਵਧੀਆ ਤੁਸੀਂ ਮੈਨੂੰ ਦੱਸ ਸਕਦੇ ਹੋ ਅੱਛਾ ਜੀ ਓ ਵਾਹ ਜੀ ਵਾਹ ਭਾਅ ਜੀ ਇੱਕ ਭਾਅ ਜੀ ਇੱਕ ਨਾ ਮੇਰੇ ਨਾ ਹੇਅਰ ਫਾਲ ਬਹੁਤ ਹੋ ਰਹੇ ਆ ਮੈਂ ਨਾ ਹੇਅਰ ਸੀਰਮ ਦੀ ਵਰਤਦਾ ਤੇ ਸ਼ੈਂਪੂ ਵੀ ਮੈਂ ਵਧੀਆ ਕੰਡੀਸ਼ਨ ਰੱਖਿਆ ਵਾ ਹਨਾ ਤੇ ਮੈਂ ਡੇਲੀ ਵਾਸ਼ ਵੀ ਕਰਦਾ ਨਾਲੇ ਮਤਲਵ ਐਂ ਵੀ ਨੀ ਹੈਗਾ ਜਿਆਦਾਤਰ ਵੋਮ ਵੋਟਰ ਨਾਲ ਕਰਦਾ ਜਾਂ ਕੋਲਡ ਵੋਟਰ ਨਾਲ ਕਰਦਾ ਬਸ ਸਿੰਪਲ ਮਿਕਸ ਜਿਹਾ ਨਾ ਉਹਦੇ ਨਾਲ ਕਰਦਾ ਤੇ ਜੇ ਮਤਲਬ ਉਹਨੂੰ ਮੈਂ ਡਰਾਇਅਰ ਥੋੜਾ ਜਿਹਾ ਡਰਾਇਅਰ ਨਾਹ ਧੋ ਕੇ ਵੀ ਨਾ ਜਦੋਂ ਵਾਲ ਮੈਂ ਧੋ ਹੱਟਦਾ ਤੇ ਮੈਨੂੰ ਡਰਾਇਅਰ ਬਹੁਤ ਫੇਰਦਾ ਉਹਦੇ ਪਰ ਇੱਕ ਮੈਨੂੰ ਲੱਗਦਾ ਸ਼ਾਇਦ ਉਹਦੇ ਕਰਕੇ ਵੀ ਦਿੱਕਤ ਆ ਸਕਦੀ ਬਾਕੀ ਤੁਸੀਂ ਦੱਸੋ ਭਾਅ ਜੀ ਹੁਣ ਤੁਸੀਂ ਪ੍ਰੋਫੈਸ਼ਨਲ ਹੋ ਮੈਂ ਭਾਅ ਜੀ ਪੋ ਪੋ ਪੋਂਡਸ ਐ ਜੀ ਪੋਂਡਸ ਪੋਂਡਸ ਦਾ ਹੀ ਉਹ ਸ਼ੈਂਪੂ ਆ ਪੋਂਜਸ ਦਾ ਹੀ ਕਡੀਸ਼ਨਰ ਆ ਤੇ ਸੀਰਪ ਭਾਅ ਜੀ ਮੈਂ ਦੇਖ ਕੇ ਦੱਸਦੂੰਗਾ ਬਾਅਦ ਚੋਂ ਤੇ ਫਿਰ ਫੋਟੋ ਭੇਜ ਦੂੰਗਾ ਸਿਰਮ ਦੀ ਮੈਨੂੰ ਉਹਦਾ ਨਾਮ ਨਹੀਂ ਯਾਦ ਥੋੜਾ ਜੀ ਹਾਂਜੀ ਹਾਂਜੀ

ਓਕੇ ਓਕੇ ਜੀ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਮੇਰੇ ਭਾਅ ਜੀ ਵਾਲ ਭਾਰੇ ਨੇ ਜੀ ਓਕੇ ਭਾਅ ਜੀ ਇਹ ਭਾਅ ਜੀ ਜੇ ਬਿਮਾਰ ਹੋ ਗਏ ਜੀ ਫੇਰ ਮੈਂ ਅੱਛਾ ਜੀ ਠੰਡੇ ਪਾਣੀ ਨਾਲ ਨਹਾਣਾ ਈ ਪੈਣਾ ਹੈਂ ਭਾਅ ਜੀ ਨਲ ਨਲਕੇ ਨਲਕੇ ਆਲੇ ਪਾਣੀ ਨਾਲ ਨੀ ਨਾਹ ਸਕਦਾ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਚਲੋ ਫਿਰ ਤਾਂ ਠੀਕ ਆ ਭਾਅ ਜੀ ਕੋਈ ਮੈਂ ਤੁਹਾਡੇ ਕੋਲ ਗੇੜਾ ਮਾਰੂਗਾ ਜੀ ਨਹੀਂ ਨਹੀਂ ਨਹੀਂ ਭਾਅ ਜੀ ਠੀਕ ਹ ਜੀ ਸਾਰਾ ਕੁਝ ਅਰੋਕਿਆ ਓਕੇ ਓਕੇ ਓਕ